ਸਤਿ ਸ਼੍ਰੀ ਆਕਾਲ ਜੀ ਮੇਰਾ ਨਾਮ ਸਲੋਨੀ ਹੈ ਮੈਂ ਅੰਮ੍ਰਿਤਸਰ ਦੀ ਰਹਿਣ ਵਾਲ਼ੀ ਹਾਂ ਅਤੇ ਮੈਂ ਇਸ ਸਮੇਂ ਰੇਲ ਗੱਡੀ ਵਿੱਚ ਸਫਰ ਕਰ ਰਹੀ ਹਾਂ ਮ ਮੌਸਮ ਦੇ ਕਾਰਨ ਸਾਡੀ ਰੇਲ ਗੱਡੀ ਦੋ ਘੰਟੇ ਲਈ ਮੋਹਾਲੀ ਜ਼ਿਲ੍ਹੇ ਵਿੱਚ ਸਟੇਅ ਕਰ ਰਹੀ ਹੈ ਅਤੇ ਮੈਂ ਅਤੇ ਮੇਰੇ ਮਾਤਾ ਪਿਤਾ ਜੀ ਅਤੇ ਮੇਰੇ ਭੈਣ ਭਰਾ ਵੀ ਮੇਰੇ ਨਾਲ਼ ਹੀ ਹਨ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ ਅਤੇ ਉਨ੍ਹਾਂ ਨੂੰ ਵੀ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ ਮੈਨੂੰ ਮਨਚਰਜ ਫੂਡ ਕੋਟ ਹੀ ਸਭ ਤੋਂ ਨਜ਼ਦੀਕ ਲੱਗਿਆ ਇਸ ਲਈ ਮੈਂ ਤੁਹਾਡੀ ਤੁਹਾਡੇ ਨਾਲ ਬੇਨਤੀ ਕਰਦੀ ਹਾਂ ਕਿ ਤੁਸੀਂ ਕੁਛ ਨਾ ਕੁਛ ਔਡਰ ਡਿਲੀਵਰ ਕਰ ਦਿਓ ਅਤੇ ਮੈਂ ਤੇ ਮੈਨੂੰ ਅਗਰ ਤੁਸੀਂ ਔਡਰ ਕਰ ਸਕਦੇ ਹੋ ਤਾਂ ਮੈਨੂੰ ਦੱਸੋ ਕਿ ਕਿੰਨੇ ਟਾਈਮ ਲਈ ਔਡਰ ਕਿੰਨੇ ਟਾਈਮ ਤੱਕ ਔਡਰ ਡਿਲੀਵਰ ਹੋ ਸਕਦਾ ਹੈ ਅਤੇ ਮੈਂ ਕੈਸ਼ ਨਹੀਂ ਦੇ ਸਕਦੀ ਤੁਸੀਂ ਗੂ ਜੇਕਰ ਤੁਹਾਡਾ ਗੂਗਲ ਪੇਅ ਚੱਲਦਾ ਹੈ ਤਾਂ ਮੈਂ ਤੁਹਾਨੂੰ ਹੁਣੇ ਹੀ ਕੈਸ਼ ਪੇਮੈਂਟ ਕਰ ਸਕਦੀ ਹਾਂ ਅਤੇ ਜੇਕਰ ਨਹੀਂ ਚੱਲਦਾ ਤਾਂ ਤੁਸੀਂ ਆਪਣੇ ਡਿਲੀਵਰੀ ਬੁਆਏ ਨਾਲ ਸਕੈਨਰ ਭੇਜ ਦਿਓ ਅਤੇ ਮੈਂ ਉਸ ਟਾਈਮ ਸਕੈਨ ਕਰਕੇ ਤੁਹਾਨੂੰ ਪੇਮੈਂਟ ਕਰ ਦੇਵਾਂਗੀ ਧੰਨਵਾਦ